ਹਾਂ ਇਹ ਇੱਕ ਸੱਚ ਗੱਲ ਹੈ ਕਿ ਹਰ ਥਾਂ ਫੈਸ਼ਨ ਜਿੱਦਾਂ ਫੈਸ਼ਨ ਰੁਝਾਨ ਹੈ ਜਿਹੜਾ ਉਹ ਕੀ ਹੈ ਵੀ ਕਿਤੇ ਨਾ ਕਿਤੇ ਜਾ ਕੇ ਉਹ ਜਿਵੇਂ ਅੱਜ ਕੱਲ੍ਹ ਦੀਆਂ ਆਪਣੀਆਂ ਫਿਲਮਾਂ ਜਾਂ ਇੱਦਾਂ ਮਤਲਬ ਟੀਵੀ ਵੱਡੇ ਪਰਦੇ ਤੋਂ ਪ੍ਰਭਾਵਿਤ ਹੁੰਦਾ ਕਿਤੇ ਨਾ ਕਿਤੇ ਇਹ ਜਿਹੜਾ ਆਪਣਾ ਪਹਿਰਾਵਾ ਇਹ ਚੀਜ਼ਾਂ ਨਾਲ ਜ਼ਰੂਰ ਕਿਤੇ ਨਾ ਕਿਤੇ ਪ੍ਰਭਾਵਿਤ ਹੁੰਦਾ ਹੁਣ ਆਪਾਂ ਜੇ ਗੱਲ ਕਰੀਏ ਤਾਂ ਕਈ ਫਿਲਮਾਂ ਇਹੋ ਜਿਹੀਆਂ ਵੀ ਹੈਗੀਆਂ ਨੇ ਜਿੱਦਾਂ ਆਪਾਂ ਪੰਜਾਬ ਦੇ ਵਿੱਚ ਰਹਿ ਰਹੇ ਹਾਂ ਹੈ ਨਾ ਤਾਂ ਜਿਹੜਾ ਪੁਰਾਣਾ ਆਪਣਾ ਪੰਜਾਬੀ ਸੱਭਿਆਚਾਰ ਹੈ ਜਿਹੜਾ ਉਹਨੂੰ ਦਿਖਾਉਂਦੀਆਂ ਹੋਈਆਂ ਫਿਲਮਾਂ ਨੇ ਜਿਵੇਂ ਮੈਂ ਜੇ ਮੈਂ ਨਾਮ ਲੈਣਾ ਚਾਹਾਂ ਤਾਂ ਜਿੱਦਾਂ ਅੰਗਰੇਜ਼ ਹੋ ਗਈ ਅੰਗਰੇਜ਼ ਫਿਲਮ ਹੋ ਗਈ ਗੋਰਿਆਂ ਨੂੰ ਦਫਾ ਕਰੋ ਫਿਲਮ ਹੋ ਗਈ ਤਾਂ ਇਹ ਇਹਦੇ 'ਚ ਕੀ ਆਪਣਾ ਪੰਜਾਬੀ ਜਿਹੜਾ ਪੁਰਾਣਾ ਪੰਜਾਬ ਸੀਗਾ ਮਤਲਬ ਉਹਦਾ ਕਿਤੇ ਨਾ ਕਿਤੇ ਉਹ ਕੀਤਾ ਹੋਇਆ ਹੈ ਨਾ ਵਰਣਨ ਉਹਦੇ ਵਿੱਚ ਜਿੱਦਾਂ ਜਿੱਦਾਂ ਬੰਦੇ ਨੇ ਹੈ ਨਾ ਉਹਨਾਂ ਨੇ ਉਹ ਚਾਦਰਾ ਲਾਇਆ ਹੋਇਆ ਹੈ ਨਾ ਜਿੱਦਾਂ ਆਪਣੇ ਪੁਰਾਣੇ ਉਹਦੇ 'ਚ ਹੁੰਦਾ ਸੀ ਅਤੇ ਜੇ ਆਪਾਂ ਬੁੜੀਆਂ ਦੇ ਪਾਸੇ ਗੱਲ ਕਰੀਏ ਤਾਂ ਪੁਰਾਣੇ ਜਿੱਦਾਂ ਪੰਜਾਬੀ ਆਪਣੇ ਸੂਟ ਹੋ ਗਏ ਪਰਾਂਦਾ ਹੋ ਗਿਆ ਇੱਦਾਂ ਦੀਆਂ ਚੀਜ਼ਾਂ ਮਤਲਬ ਪਾਈਆਂ ਹੋਈਆਂ ਤਾਂ ਇਹਦੇ 'ਚ ਇਹੋ ਜਿਹੀਆਂ ਜਿਹੜੀਆਂ ਫਿਲਮਾਂ ਨਾ ਕਿਤੇ ਨਾ ਕਿਤੇ ਮੈਨੂੰ ਲੱਗਦਾ ਜਿਹੜੀਆਂ ਆਪਣੀ ਆਉਣ ਮਤਲਬ ਹੁਣ ਜਿਹੜੀ ਪੀੜ੍ਹੀ ਚੱਲ ਰਹੀ ਹੈ ਬਾਕੀ ਆਉਣ ਵਾਲੀਆਂ ਪੀੜ੍ਹੀਆਂ ਨੇ ਉਹਨਾਂ ਨੂੰ ਕਿਤੇ ਨਾ ਕਿਤੇ ਇਹ ਇਹ ਫਿਲਮਾਂ ਇੱਕ ਸੇਧ ਨੇ ਸੇਧ ਮਤਲਬ ਵੀ ਜਿੱਦਾਂ ਉਹਦੇ 'ਚ ਆਪਾਂ ਨੂੰ ਪਤਾ ਲੱਗਦਾ ਹੁਣ ਜਿਹੜੇ ਅੱਜ ਕੱਲ੍ਹ ਦੇ ਆਪਣੇ ਨੌਜਵਾਨੀ ਹੈ ਉਹਦੇ 'ਚ ਕਿਤੇ ਨਾ ਕਿਤੇ ਆਪਾਂ ਕਹਿ ਲਈਏ ਵੀ ਜਿਹੜਾ ਬਾਹਰਲੇ ਮੁਲਕਾਂ ਦਾ ਜ਼ਿਆਦਾ ਪ੍ਰਭਾਵ ਹੈ ਤਾਂ ਮਤਲਬ ਵੀ ਕਿਤੇ ਨਾ ਕਿਤੇ ਆਪਾਂ ਕਹਿ ਲਈਏ ਆਪਾਂ ਹੈ ਨਾ ਵੀ ਆਪਣੇ ਪਹਿਰਾਵੇ ਦੇ ਵਿੱਚ ਉਸ ਚੀਜ਼ ਦਾ ਬਹੁਤ ਜ਼ਿਆਦਾ ਅਸਰ ਹੋ ਰਿਹਾ ਹੈਗਾ ਤਾਂ ਇਹ ਫਿਲਮਾਂ ਦੇ ਵਿੱਚੋਂ ਆਪਾਂ ਉਹਨਾਂ ਨੂੰ ਇਹ ਸੇਧ ਮਿਲੇਗੀ ਕਿ ਮਤਲਬ ਅ ਉਹਦੇ 'ਚ ਆਪਣਾ ਜਿੱਦਾਂ ਪੁਰਾਣਾ ਪਹਿਰਾਵਾ ਸੀ ਕੀ ਆਪਣਾ ਸੱਭਿਆਚਾਰ ਸੀਗਾ ਮਤਲਬ ਕਿੰਨਾ ਅਮੀਰ ਆਪਾਂ ਕਹਿ ਲਈਏ ਵੀ ਕਿੰਨਾ ਅਮੀਰ ਉਹ ਸੱਭਿਆਚਾਰ ਸੀਗਾ ਅਤੇ ਜੇ ਮੈਂ ਗੱਲ ਕਰਾਂ ਵੀ ਇਹ ਪਹਿਰਾਵਾ ਮਤਲਬ ਬਣਾਉਣ ਦੀ ਹੁਣ ਆਪਾਂ ਜੇ ਗੱਲ ਕਰੀਏ ਕਈ ਸਕੂਲ ਹੈਗੇ ਨੇ ਹੈ ਨਾ ਇੱਦਾਂ ਦੇ ਤਾਂ ਆਪਣੇ ਸਕੂਲਾਂ ਦੇ ਵਿੱਚ ਇੱ ਕ ਸਾਲ ਦੇ ਵਿੱਚ ਇੱਕ ਵਾਰੀ ਉਹ ਕਰਵਾਇਆ ਜਾਂਦਾ ਜਿਹਨੂੰ ਆਪਾਂ ਅੰਗਰੇਜ਼ੀ 'ਚ ਨਾਮ ਦਿੰਦੇ ਹਾਂ ਫੈਂਸੀ ਡਰੈਸ ਕੰਪੀਟੀਸ਼ਨ ਉਹਦੇ 'ਚ ਕੀ ਹੁੰਦਾ ਵੀ ਤੁਹਾਡੀ ਮਰਜ਼ੀ ਦੇ ਹਿਸਾਬ ਨਾਲ ਤੁਸੀਂ ਹਾਂ ਕੱਪੜੇ ਪਾ ਕੇ ਜਾਣੇ ਹੁੰਦੇ ਆ ਤਾਂ ਬੱਚੇ ਅੱਜ ਕੱਲ੍ਹ ਦੇ ਮਾਂ ਪਿਓ ਜਿੱਦਾਂ ਬੱਚਿਆਂ ਨੂੰ ਆਪਾਂ ਕਹਿ ਲਈਏ ਵੀ ਕਿਸੇ ਪਰੀ ਦਾ ਹੈ ਨਾ ਪਰੀ ਦੀ ਡਰੈਸ ਪਵਾਤੀ ਤਾਂ ਰਾਵਣ ਹੋ ਗਿਆ ਕੋਈ ਹੈ ਨਾ ਵੀ ਕਿਸੇ ਨੇ ਮਤਲਬ ਸ਼੍ਰੀ ਰਾਮ ਦਾ ਆਪਾਂ ਰੂਪ ਕੋਈ ਉਹ ਉਹ ਬਣਾਉਂਦਾ ਮਤਲਬ ਇੱਦਾਂ ਇੱਦਾਂ ਦੇ ਉਹ ਅਲੱਗ ਅਲੱਗ ਕੋਸਟਿਊਮ ਜਿਹੇ ਬੱਚਿਆਂ ਨੂੰ ਬਣਵਾਉਂਦੇ ਨੇ ਤਾਂ ਹੁਣ ਜਿੱਦਾਂ ਕਈ ਆਪਾਂ ਕਹਿ ਲਈਏ ਵੀ ਪੰਜਾਬੀ ਸੂਟ ਪੰਜਾਬੀ ਘੱਗਰਾ ਪਾ ਕੇ ਪੰਜਾਬੀ ਸੂਟ ਪਰਾਂਦਾ ਹੋ ਗਿਆ ਟਿੱਕਾ ਹੋ ਗਿਆ ਵੀ ਇਹੋ ਜਿਹੀਆਂ ਚੀਜ਼ਾਂ ਲਾ ਕੇ ਵੀ ਆਪਾਂ ਇਹੋ ਜਿਹੀਆਂ ਚੀਜ਼ਾਂ ਲਾ ਕੇ ਵੀ ਵੀ ਆਪਾਂ ਮਤਲਬ ਮੈਨੂੰ ਲੱਗਦਾ ਵੀ ਉਹ ਕਿਤੇ ਨਾ ਕਿਤੇ ਵੀ ਆਪਣਾ ਜਿਹੜਾ ਪਿਛੋਕੜ ਹੈ ਉਹਨੂੰ ਆਪਾਂ ਨੂੰ ਨਹੀਂ ਭੁੱਲਣਾ ਚਾਹੀਦਾ ਅਤੇ ਮਤਲਬ ਜੇ ਉਹਦੇ ਵਿੱਚ ਮਤਲਬ ਇਹ ਆਪਾਂ ਜਿਵੇਂ ਵੀ ਜੇ ਕੁੜੀ ਹੈ ਤਾਂ ਕੁੜੀ ਨੂੰ ਆਪਾਂ ਕਹਿ ਲੀਏ ਘੱਗਰਾ ਪਰਾਂਦਾ ਅਤੇ ਇਹ ਫੁਲਕਾਰੀ ਵਗੈਰਾ ਦੇ ਕੇ ਉੱਥੇ ਮਤਲਬ ਉਹ ਕਰਵਾਇਆ ਜਾਵੇ ਹੈ ਨਾ ਤਾਂ ਮਤਲਬ ਸਹੀ ਹੈ ਵੀ ਮਤਲਬ ਆਪਾਂ ਨੂੰ ਇੱਦਾਂ ਸ਼ੋ ਕਰਨਾ ਚਾਹੀਦਾ ਉੱਥੇ ਉਹਦੇ ਉਹ ਸਟੇਜ ਉੱਪਰ ਤਾਂ ਜਿੱਦਾਂ ਲੜਕੇ ਨੇ ਲੜਕਿਆਂ ਦੇ ਵਿੱਚ ਆਪਾਂ ਕਹਿ ਲਈਏ ਵੀ ਕੁੜਤਾ ਪਜਾਮਾ ਹੋ ਗਿਆ ਚਾਦਰੇ ਹੋ ਗਏ ਉਹ ਵੀ ਸਹੀ ਹੈਗਾ